ਯੋਗਾ ਕਰਕੇ ਸਵੇਰੇ ਸਵੇਰੇ ਮੇਰੇ ਦਿਮਾਗ ਨੂੰ ਇਹ ਬੜੀ ਵਧੀਆ ਸੋਚ ਮਿਲਦੀ ਹੈ ਅਤੇ ਆਪਣੇ ਪਰੀਚਕ ਸਕਾਰਾਤਮਕ ਭਾਵਨਾ ਪੈਦਾ ਹੁੰਦੀ ਹੈ ਅਸੀਂ ਜਦੋਂ ਸਵੇਰੇ ਉੱਠ ਕੇ ਯੋਗਾ ਕਰਨ ਜਾਂਦੇ ਹਾਂ ਤਾਂ ਸਾਡੇ ਸਾਰੇ ਸਰੀਰ ਨੂੰ ਉਸਦੀ ਐਕਸਰਸਾਈਜ਼ ਹੁੰਦੀ ਹੈ ਯੋਗਾ ਕਰਨ ਨਾਲ ਸ ਸ ਹਰ ਤਰ੍ਹਾਂ ਦੀ ਸ ਸੋਚ ਖਤਮ ਹੋ ਜਾਂਦੀ ਹੈ ਨੈਗਟਿਵ ਸੋਚ ਨਹੀਂ ਆਉਂਦੀ ਨਕਾਰਾਤਮਕ ਤੋਂ ਸਕਾਰਾਤਮਕ ਸੋਚ ਬਣ ਜਾਂਦੀ ਹੈ ਤਾਂ ਜੇ ਜੇ ਅਸ ਅਸੀਂ ਯੋਗਾ ਕਰਦੇ ਹਾਂ ਤਾਂ ਸਾ ਅਸੀਂ ਉੱਥੇ ਜਾ ਕੇ ਜਦੋਂ ਯੋਗਾ ਕਰਦੇ ਹਾਂ ਸਾਰੇ ਇੱਕੋ ਜਿਹੇ ਸਾ ਇਕੱਠੇ ਹੋਏ ਹੁੰਦੇ ਹਨ ਇੱਕ ਦੂਸਰੇ ਨੂੰ ਦੇਖ ਕੇ ਹੀ ਸਾਡੀ ਭਾਵਨਾ ਬਦਲ ਜਾਂਦੀ ਹੈ ਅਤੇ ਸਾਡੇ ਦਿਮਾਗ ਦੀ ਸੋਚ ਵੀ ਬਦਲ ਜਾਂਦੀ ਹੈ ਸਾਡੇ ਦਿਮਾਗ ਵਿੱਚ ਇਹ ਹੀ ਆਉਂਦਾ ਹੈ ਕਿ ਜੇ ਉਹ ਕਰ ਰਿਹਾ ਹੈ ਤਾਂ ਮੈਂ ਕਿਉਂ ਨਹੀਂ ਕਰ ਸਕਦਾ ਹੋ ਹੌਲੀ ਹੌਲੀ ਯੋਗਾ ਕਰਨ ਨਾਲ ਸਾਡੀ ਸਰੀਰ ਦੀਆਂ ਸ ਕਾਫੀ ਜ਼ਿਆਦਾ ਬਿਮਾਰੀਆਂ ਠੀਕ ਹੋ ਜਾਂਦੀਆਂ ਹਨ ਯੋਗਾ ਹਰ ਰੋਜ਼ ਕਰਨਾ ਪੈਂਦਾ ਹੈ ਇਹ ਨਹੀਂ ਕਿ ਇੱਕ ਦਿਨ ਕੀਤਾ ਅਤੇ ਫਿਰ ਨਹੀਂ ਕੀਤਾ ਯੋਗਾ ਲਗਾਤਾਰ ਕਰੋ ਤਾਂ ਦਿਮਾਗ ਦੀ ਸੋਚ ਵੀ ਬਦਲ ਜਾਂਦੀ ਹੈ ਸਾਨੂੰ ਪਹਿਲਾਂ ਸਾਡੇ ਦਿਮਾਗ ਵਿੱਚ ਨਕਾਰਾਤਮਕ ਭਾਵਨਾਵਾਂ ਆਉਂਦੀਆਂ ਹਨ ਕਿ ਨਹੀਂ ਮੈਂ ਇਹ ਨਹੀਂ ਕਰ ਸਕਦੀ ਲੇਕਿਨ ਸਭ ਜੇ ਕਰੋ ਤਾਂ ਸਭ ਕੁਛ ਹੋ ਸਕਦਾ ਹੈ ਯੋਗਾ ਕਰਨ ਨਾਲ ਛ ਕਈ ਬਿਮਾਰੀਆਂ ਠੀਕ ਹੁੰਦੀਆਂ ਹਨ ਜਿਸ ਤਰ੍ਹਾਂ ਕਿ ਕਈ ਵਾਰ ਕਿਸੇ ਨੂੰ ਕੋਈ ਬਿਮਾਰੀ ਲੱਗ ਜਾਂਦੀ ਹੈ ਜਿਸਦਾ ਸਾਹ ਦੀ ਤਕਲੀਫ਼ ਹੋਵੇ ਤਾਂ ਉਸ ਨੂੰ ਵੀ ਸ ਕਿ ਸਹੀ ਕੀਤਾ ਲੰਬੇ ਲੰਬੇ ਸਾਹ ਲੈ ਕੇ ਠੀਕ ਕੀਤਾ ਜਾ ਸਕਦਾ ਹੈ ਧੰਨਵਾਦ